ਹੈਲੋ ਹਾਂਜੀ ਹਾਂਜੀ ਜੀ ਵਧੀਆ ਵਧੀਆ ਭਾਅ ਜੀ ਤੁਸੀਂ ਸੁਣਾਓ ਕੀ ਸੇਵਾ ਕਰੀਏ ਮੇਰਾ ਨਾਮ ਇਸ਼ਾਨ ਭਾਅ ਜੀ ਹਾਂਜੀ ਹਾਂਜੀ ਨੂਡਲ ਭਾਅ ਜੀ ਦੇਖਿਆ ਜਾਵੇ ਤਾਂ ਕਈ ਥਾਵਾਂ ਇੱਥੇ ਮਤਲਬ ਤੁਸੀਂ ਰੇਹੜੀ ਦੇ ਖਾਣੇ ਚਾਹੁੰਦੇ ਹੋ ਰੈਸਟੋਰੈਂਟ ਦੇ ਖਾਣਾ ਚਾਹੁੰਦੇ ਹੋ ਕਿਹੜੇ ਖਾਣਾ ਚਾਹੁੰਦੇ ਹੋ ਰੇਹੜੀ ਦੇ ਤੁਸੀਂ ਦਿਨੇਸ਼ ਫਾਸਟ ਫ਼ੂਡ ਜਾ ਸਕਦੇ ਹੋ ਹੋਰ ਹੈਗੀਆਂ ਜਿਹੜੀ ਇੱਥੇ ਫ਼ੂਡ ਸਟਰੀਟ ਚੌਪਾਟੀ ਹੈ ਤੁਸੀਂ ਉੱਥੇ ਜਾ ਸਕਦੇ ਹੋ ਉੱਥੇ ਕਈ ਰੇਹੜੀਆਂ ਉੱਥੇ ਤੁਸੀਂ ਖਾ ਸਕਦੇ ਹੋ ਮਨਚੂਰੀਅਨ ਤਾਂ ਦੇਖੋ ਜੀ ਜੇ ਤੁਹਾਨੂੰ ਦੇਸੀ ਚਾਇਨੀਜ਼ ਵਾਲਾ ਮਨਚੂਰੀਅਨ ਚਾਹੀਦਾ ਤਾਂ ਹਿਮਾਨੀਆਂ ਫਾਸਟ ਫ਼ੂਡ ਦੇ ਜਾਓ ਉਹ ਵਧੀਆ ਵਾ ਇਹ ਤੁਹਾਡਾ ਪੈ ਜਾਣਾ ਮੇਨ ਪੋਸਟ ਔਫਿਸ ਨਹੀਂ ਹੈ ਜਿੱਥੇ ਸਿਵਲ ਲਾਈਨ ਉਹਦੇ ਓਪੋਜ਼ਿਟ ਹੀ ਹੈ ਇੱਕ ਤਰ੍ਹਾਂ ਨਾਲ ਸੈਂਡਵਿਚ ਨਰੰਗ ਕੈਫੇਟੇਰੀਆ ਇਹ ਆਪਣਾ ਪੈਣਾ ਓਪੋਜ਼ਿਟ ਵੀ ਐੱਨ ਵੀ ਪਾਰਕ ਸਟੇਸ਼ਨ ਚੌਂਕ ਸੋਇਆ ਕੈਫ਼ੇ ਇਹ ਹੈਗਾ ਤੁਹਾਡਾ ਗਲੋਬਲ ਸਟੂਕ ਕਲੋਕ ਟਾਵਰ ਔਰ ਘੈਂਟਾ ਘਰ ਦੇ ਕੋਲ ਹੈ ਇਹ

ਪੈਟੀ ਤੁਸੀਂ ਸਰਤਾਜ ਬੇਕਰੀ ਦੀ ਖਾ ਸਕਦੇ ਹਾਂ ਰਾਜੇਸ਼ ਬੇਕਰੀ ਦੀ ਖਾ ਸਕਦੇ ਹਾਂ ਕਈ ਤਰ੍ਹਾਂ ਦੀਆਂ ਬੇਕਰੀਆਂ ਤੁਸੀਂ ਉਨ੍ਹਾਂ 'ਚੋਂ ਕਿਸੇ ਦੇ ਵੀ ਖਾ ਸਕਦੇ ਅਤੇ ਡੀਲਕਸ ਬੇਕਰੀ ਦੇ ਖਾ ਸਕਦੇ ਹੋ ਫਰੈਂਚ ਦੀ ਵੀ ਵਧੀਆ ਹੁੰਦੀ ਉਹਦੀ ਵੀ ਖਾ ਸਕਦੇ ਹੋ ਸਰਤਾਜ ਹੈਗਾ ਭਾਅ ਜੀ ਸਤੈਰੀ ਰੋਡ 'ਤੇ ਬ੍ਰੇਕਫਾਸਟ ਇੱਥੇ ਤਾਂ ਜੀ ਪੂਰੀਆਂ ਕਚੌਰੀਆਂ ਇਹ ਸਭ ਫੇਮਸ ਆ ਜ਼ਿਆਦਾ ਚੱਲਦਾ ਜਿਹੜਾ ਪੂਰੀਆਂ ਜੀ ਕਈ ਥਾਵਾਂ ਭੀਲੋ ਭਾਈ ਰਾਮਾ ਰਿਫਰੈਸ਼ਮੈਂਟ ਹੋਰ ਆਪਣਾ ਸੁੱਖਾ ਹੋਰ ਮੋਹਣਾ ਹੋਰ ਕੰਦੀ ਪਹਿਲਵਾਨ ਕਈ ਤਰ੍ਹਾਂ ਦੀ ਪੂਰੀਆਂ ਵਾਲੇ ਹੈਗੇ ਇੱਥੇ ਕੰਦੀ ਪਹਿਲਵਾਨ ਸਵੇਰੇ ਪੋਣੇ ਅੱਠ ਤੋਂ ਗਿਆਰ੍ਹਾਂ ਵਜੇ ਦੇ ਵਿੱਚ ਵਿੱਚ ਚੱਲ ਜੋ ਗਿਆਰ੍ਹਾਂ ਬਾਰ੍ਹਾਂ ਦੇ ਵਿੱਚ ਵਿੱਚ ਮਿਲਜੂਗੀ ਤੁਹਾਨੂੰ ਅੱਠ ਵਜੇ ਤੋਂ ਬਾਅਦ ਤਾਂ ਨਾਨ ਇੱਕ ਦੇਵੀ ਦੇ ਮਿਲ ਜਾਊਗੇ ਵਧੀਆ ਜੱਗੂ ਦੇ ਨਾਨ ਵਧੀਆ ਫੇਮਸ ਆ ਇੱਥੇ ਦੇ ਅੰਮ੍ਰਿਤਸਰੀ ਨਾਨ ਦੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਉਹ ਮਿਲਜੂਗੇ ਤੁਹਾਨੂੰ ਉੱਥੇ ਉਹਦੇ ਜੱਗੂ ਦੇ ਮਿਲਜੂਗੇ ਅਨੰਤੀ ਏਰੀਆ ਦੇ ਮਿਲਜੂਗੇ ਹੋਰ ਵੀ ਕਈ ਥਾਵਾਂ ਹੈਗੀਆਂ ਵਾ ਉੱਥੇ ਮਿਲਜੂਗੇ ਪਰ ਦੋ ਇਹ ਫੇਮਸ ਹੈ ਜੱਗੂ ਹੈਗਾ ਜੀ ਸ਼ਿਮਲਾ ਪਹਾੜੀ ਹਾਂਜੀ ਹਾਂਜੀ ਚਿਕਨ ਦੀ ਦੇਖੋ ਚਿਕਨ ਇੱਥੇ ਅੰਬਰ ਹੋਟਲ ਆ ਬੱਸ ਸਟੈਂਡ ਦੇ ਨਾਲ ਮਤਲਬ ਬੱਸ ਸਟੈਂਡ ਦੇ ਕੋਲ ਉੱਥੇ ਵਧੀਆ ਮਿਲਜੂਗਾ ਤੁਹਾਨੂੰ ਡੋਸਾ ਸਾਗਰ ਰਤਨਾ ਵਧੀਆ ਹੁੰਦਾ ਪਰ ਸਾਗਰ ਰਤਨਾ ਦਾ ਤੁਹਾਨੂੰ ਜਿਹੜਾ ਵਾ ਇੱਕ ਵਧੀਆ ਮਿਲਜੂਗਾ ਮਤਲਬ ਇੱਕ ਟਰਸਟਿਡ ਬਰੈਂਡ ਆ ਟਰਸਟਿਡ ਉਹ ਆ ਕਿਚਨ ਆ ਉਹ ਫਿਰ ਤੁਸੀਂ ਇੱਥੇ ਇੱਕ ਮਿੰਗਲ ਮੋਮੋਸ ਆ ਉਹਦੇ ਮੋਮੋਸ ਖਾ ਸਕਦੇ ਹੋ ਉਹ ਬਹੁਤ ਸਵਾਦ ਹੁੰਦੇ ਫਲੂਦਾ ਵਗੈਰਾ ਵੀ ਤੁਹਾਨੂੰ ਚੌਪਾਟੀ ਫ਼ੂਡ ਸਟ੍ਰੀਟ 'ਤੇ ਮੇਵਾੜ ਦੇ ਨਾਮ ਦੇ ਟਰੱਕ ਮਿਲੂਗੇ ਉੱਥੇ ਤੁਸੀਂ ਕਿਤਿਓਂ ਵੀ ਪੀ ਲਿਆ ਸਵਾਦ ਹੁੰਦਾ ਠੀਕ ਹੈ ਭਾਅ ਜੀ ਓਕੇ ਜੀ ਓਕੇ